ਅੱਜ ਦਾ ਪੰਜਾਬ ਰਾਵੀ ਸਤਲੁਜ ਅਤੇ ਬਿਆਸ ਦਰਿਆ ਨਾਲ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਪਹਿਲਾ ਭਾਗ ਮਾਝਾ ਦੂਜਾ ਭਾਗ ਦੁਆਬਾ ਅਤੇ ਤੀਜਾ ਭਾਗ ਮਾਲਵਾ ਏਰੀਆ ਏ ਹੈ ਜਿਸ ਦੇ ਵਿੱਚ ਮਾਲਵੇ ਏਰੀਏ ਵਿੱਚ ਪੰਦਰ੍ਹਾਂ ਡਿਸਟ੍ਰਿਕਟ ਆਉਂਦੀਆਂ ਨੇ ਜਿਸ ਦੇ ਵਿੱਚ ਇੱਕ ਉਪਭਾਸ਼ਾਵਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਮਾਝਾ ਮਾਝੀ ਮਾਲਵੀ ਦੁਆਬੀ ਅਤੇ ਪੁਆਧੀ ਪੁਆਧੀ ਅਤੇ ਮਾਲਵਈ ਜਿਹੜੀ ਆ ਉਹ ਕੁਛ ਹੱਦ ਤੱਕ

ਅਲ ਤਬਦੀਲ ਹੋ ਜਾਂਦੀਆਂ ਨੇ ਅਤੇ ਜੇਕਰ ਦੇਖਿਆ ਜਾਵੇ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਇੱਕ ਲਿਖਤ ਬੋਲੀ ਹੈ ਜਿਹੜੀ ਮਾਝੇ ਏਰੀਆ ਦੇ ਵਿੱਚੋਂ ਨਿਕਲ ਕੇ ਆਈ ਹੈ ਅਤੇ ਕੁਛ ਲਹਿਜੇ ਨੇ ਜਿਹੜੇ ਅਲੱਗ ਅਲੱਗ ਉਪ ਭਾਸ਼ਾਵਾਂ ਵਿੱਚ ਬੋਲੇ ਜਾਂਦੇ ਆ ਕਿਸੇ ਉਪਭਾਸ਼ਾ ਦੇ ਵਿੱਚ ਕੀ ਕਰਨ ਡਿਆਂ ਬੋਲਿਆ ਜਾਂਦਾ ਏ ਅਤੇ ਜਿਹੜਾ ਸਾਡੇ ਏਰੀਆ ਦੇ ਵਿੱਚ ਆ ਉਹ ਕੀ ਕਰਦਾ ਸੀ ਬੋਲਿਆ ਜਾਂਦਾ ਠੀਕ ਆ ਅਤੇ ਕਿਸ 'ਤੇ ਬੋਲਦੇ ਕੀ ਕਰਦਾ ਹੈਗਾ ਏ ਅਤੇ ਹੈਗਾ ਏ ਅਤੇ ਕੀ ਕਰ ਕਰ ਰਿਹਾ ਹੈ ਤਾਂ ਇੱਦਾਂ ਦੇ ਜਿਹੜੇ ਕੁਛ ਐਕਸੈਂਟ ਨੇ ਇਹ ਐਕਸੈਂਟ ਹੀ ਜਿਹੜੇ ਐਂਡ ਵਾਲੇ ਆਖੀਰ ਵਾਲੇ ਜਿਹੜੇ ਐਕਸੈਂਟ ਨੇ ਉਹੀ ਭਾਸ਼ਾ ਨੂੰ ਅਲੱਗ ਤਰੀਕੇ ਨਾਲ ਬੋਲਦੇ ਨੇ ਅਤੇ ਬਾਕੀ ਜਿਹੜਾ ਇੰਨੀ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਕਿ ਬਹੁਤਾ ਸਮਝਣ 'ਚ ਦਿੱਕਤ ਆਉਂਦੀ ਆ ਪਰ ਇੱਦਾਂ ਸਾਰੀ ਭਾਸ਼ਾਵਾਂ ਦੇ ਵਿੱਚ ਸੀਮੇਲ ਉਪ ਭਾਸ਼ਾਵਾਂ ਦੇ ਵਿੱਚ ਇੱਕ ਬਰਾਬਰਤਾ ਹੈ ਜਿਹੜੀ ਪੰਜਾਬੀ ਭਾਸ਼ਾ ਦਾ ਸਹੀ ਰੂਪ ਵਜੋਂ ਨਿਖਰ ਕੇ ਆਉਂਦਾ ਹੈ